ਪੰਜ ਸਤੰਬਰ ਉੱਨੀ ਸੌ ਪਚਾਨਵੇਂ ਤਿੰਨ ਦਸੰਬਰ ਦੋ ਹਜ਼ਾਰ ਇੱਕ ਵੀਹ ਜਨਵਰੀ ਉੱਨੀ ਸੌ ਅਠਾਸੀ ਸਤਾਰਾਂ ਮਈ ਉੱਨੀ ਸੌ ਇਕਾਨਵੇਂ ਇੱਕ ਜੂਨ ਦੋ ਹਜ਼ਾਰ ਅੱਠ